ਮੈ ਰਜੇਸ਼ ਕੁਮਾਰ ਵਾਸੀ ਫਿਰੋਜ਼ਪੁਰ ਕਲਾਂ ਤੋਂ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਕਈ ਪਿੱਛੇ ਜਿਹੇ ਇੱਕ ਵਕੀਲ ਨੂੰ ਮਿਲਣ ਦਾ ਮੌਕਾ ਮਿਲਿਆ ਉਸ ਨੇ ਸਾਨੂੰ ਪੂਰੀ ਫੀਸ ਲੈਣ ਲਈ ਪ੍ਰੇਰਿਤ ਕੀਤਾ ਪਰ ਸਾਡਾ ਕੰਮ ਅਜੇ ਤੱਕ ਲਟਕਿਆ ਪਿਆ ਹੈ ਜੇਕਰ ਮੈਂ ਪੁਲਿਸ ਅਫਸਰ ਦੀ ਗੱਲ ਕਰਾਂ ਤਾਂ ਉਹ ਵੀ ਜਦੋਂ ਅਸੀਂ ਕਦੀ ਕਿਸੇ ਪੁਲਿਸ ਸਟੇਸ਼ਨ ਜਾਂਦੇ ਹਾਂ ਤਾਂ ਕਦੀ ਕਦੀ ਸਾਨੂੰ ਇੱਦਾਂ ਹੀ ਟਰਕਾ ਕੇ ਭੇਜ ਦਿੱਤਾ ਜਾਂਦਾ ਹੈ ਜਾਂ ਆਨਾ ਕਾਨੀ ਕੀਤੀ ਜਾਂਦੀ ਹੈ ਕਿ ਇਹ ਕੰਮ ਨਾ ਹੋਣ ਯੋਗ ਹੈ ਇਸ ਕੰਮ ਨੂੰ ਤੁਸੀਂ ਇਹ ਇੱਥੇ ਤੁਹਾਡਾ ਇਹ ਕੰਮ ਨਹੀਂ ਹੋਣਾ ਪੰਚਾਇਤ ਅਫਸਰ ਪੰਚਾਇਤ ਮੈਂਬਰ ਦੀ ਗੱਲ ਕਰਾਂ ਜਾਂ ਪ ਸਰਪ ਪਿੰਡ ਦੇ ਸਰਪੰਚ ਦੀ ਗੱਲ ਕਰਾਂ ਤਾਂ ਉਸ ਕੋਲ ਕਈ ਗੱਲਾਂ ਦੀ ਘਾਟ ਹੈ ਜਿਹੜੀਆਂ ਕਿ ਉਸ ਨੂੰ ਪਤਾ ਹੀ ਨਹੀਂ ਹੁੰਦੀਆਂ ਉਹ ਤਾਂ ਆਪੇ ਹੀ ਕੰਮ ਕਰੀ ਫਿਰਦੇ ਨੇ ਪਰ ਲੋਕਾਂ ਨੂੰ ਝਮੇਲਿਆਂ ਵਿੱਚ ਪਾਈ ਰੱਖਦੇ ਨੇ